ਮਾਰਸ਼ਲ ਆਰਟ ਦੀ ਸੱਭਿਆਚਾਰਕ ਅਤੇ ਇਤਿਹਾਸਿਕ ਜਿਹੜੀ ਮਹੱਤਤਾ ਹੈਗੀ ਹੈ ਉਹ ਬਹੁਤ ਜ਼ਿਆਦਾ ਹੈ ਮਾਰਸ਼ਲ ਆਰਟ ਦਾ ਇਤਿਹਾਸ ਰਿਹਾ ਹੈ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਅਕਸਰ ਹੀ ਅੱਤਿਆਚਾਰ ਕੀਤਾ ਜਾਂਦਾ ਸੀ ਮੁਗਲਾਂ ਵੱਲੋਂ ਆਪਣੇ ਸਾਡੇ ਹਿੰਦੂ ਸਮਾਜ 'ਤੇ ਜਾਂ ਕਿਸੇ ਹੋਰ ਸਾਡੇ ਭਾਈਚਾਰਕ ਸੰਬੰਧ ਦੇ ਉੱਤੇ ਤਾਂ ਉਸ ਸਮੇਂ ਦੇ ਦੌਰਾਨ ਆਪਣੇ ਆਪ ਨੂੰ ਬਚਾਉਣ ਦੇ ਲਈ ਜਿਹੜੀ ਮਾਸਟਰ ਆਪਣੇ ਮਾਰਸ਼ਲ ਆਰਟਸ ਦੀ ਜਿਹੜੀ ਕਲਾ ਹੈਗੀ ਹੈ ਉਹਨੂੰ ਜਿਹੜਾ ਵੱਖਰਾ ਇਤਿਹਾਸਿਕ ਰੂਪ ਦੇ ਕੇ ਲੋਕਾਂ ਦੇ ਵਿੱਚ ਲਿਆਉਂਦਾ ਗਿਆ ਤਾਂ ਜੋ ਲੋਕ ਆਪਣੇ ਆਪ ਨੂੰ ਸੈਲਫ ਪ੍ਰੋਟੈਕਸ਼ਨ ਆਪਣੇ ਆਪ ਨੂੰ ਖੁਦ ਸੁਰੱਖਿਅਤ ਬਣਾਉਣ ਦੇ ਲਈ ਇਸ ਕਲਾ ਦਾ ਵਰਤ ਕੇ ਆਪਣੇ ਆਪ ਨੂੰ ਸੁਰੱਖਿਅਤ ਜਾਂ ਸਾਹਮਣੇ ਵਾਲੇ ਤੋਂ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਦੇ ਹੈ ਇਹ ਮਾਰਸ਼ਲ ਆਰਟ ਦਾ ਖਾਸੀਅਤ ਹੈ ਕਿਉਂਕਿ ਇਸ ਕਲਾ ਨਾਲ ਬੰਦਾ ਆਪਣੇ ਆਪ ਨੂੰ ਦੋ ਬੰਦਿਆਂ ਦੇ ਸਮਾਨ ਸਮਝਦਾ ਹੈ